ਹੈਲੋ ਹਾਂਜੀ ਅਸੀਂ ਸਦਰ ਥਾਣਾ ਫਾਜ਼ਿਲਕਾ ਗੁਡ ਮੋਰਨਿੰਗ ਜੀ ਬੋਲੋ ਹਾਂਜੀ ਕਾਹਦੇ ਬਾਰੇ ਅੱਛਾ ਅੱਛਾ ਜੀ ਕਾਹਦੇ ਬਾਰੇ ਆਉਂਦੇ ਪਏ ਮੈਸੇਜ ਅੱਛਾ ਅੱਛਾ ਅਤੇ ਤੁਸੀਂ ਆਪਦੇ ਦੂਜੇ ਨੰਬਰ ਤੋਂ ਜਾਂ ਤੁਹਾਡੇ ਜਿਹੜੇ ਹਸਬੈਂਡ ਆ ਜਾਂ ਕੋਈ ਵੀ ਤੁਹਾਡੇ ਘਰ ਹੈਗਾ ਉਹਨਾਂ ਦੇ ਨੰਬਰ ਤੋਂ ਤੁਸੀਂ ਫੋਨ ਕਰਕੇ ਵੇਖਿਆ ਆਪਦੇ ਰਿਸ਼ਤੇਦਾਰਾਂ ਨੂੰ ਵੀ ਤੁਸੀਂ ਵਾਕਈ ਫੋਨ ਕੀਤਾ ਸਾਨੂੰ ਕਿ ਨਹੀਂ ਵੀ ਉਹ ਫਲਾਣੇ ਬੰਦੇ ਨੂੰ ਤੁਸੀਂ ਕਿਹਾ ਸੀਗਾ ਵੀ ਇਹਨਾਂ ਤੋਂ ਪੈਸੇ ਲੈ ਕੇ ਮੈਨੂੰ ਦੇ ਦਿਉ ਅੱਛਾ ਹੂੰ ਹੂੰ ਅੱਛਾ ਅੱਛਾ ਜੀ ਇੱਕ ਤਾਂ ਤੁਸੀਂ ਹੁਣ ਫੋਨ ਨਾ ਚੱਕਿਆ ਜੇ ਅਤੇ ਨਾ ਹੀ ਤੁਸੀਂ ਕੋਈ ਰਿਪਲਾਈ ਕਰਿਆ ਜੇ ਜਿਹੜੇ ਵੀ ਤੁਹਾਡੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਦੀ ਆਹ ਵਾਲੇ ਨੰਬਰਾਂ ਤੋਂ ਵਾਰੀ ਵਾਰੀ ਫੋਨ ਆਈ ਜਾਂਦਾ ਅਤੇ ਇੱਕ ਤੁਸੀਂ ਸਾਡੇ ਕੋਲ ਇੱਥੇ ਥਾਣੇ ਆ ਕੇ ਰਿਪੋਰਟ ਲਿਖਾ ਸਕਦੇ ਹੋ ਅਸੀਂ ਐਵੇਂ ਫੋਨ 'ਤੇ ਰਿਪੋਰਟ ਨਹੀਂ ਲਿਖ ਸਕਦੇ ਤੁਸੀਂ ਥਾਣੇ ਆਉਂਗੇ ਅਤੇ ਸਾਡੇ ਸਾਹਮਣੇ ਸਾਨੂੰ ਸਾਰੀ ਗੱਲ ਦੱਸੋਂਗੇ ਤੁਹਾਨੂੰ ਇੰਸਪੇਕਟਰ ਸਾਹਿਬ ਨਾਲ ਮਿਲਾਵਾਂਗੇ ਫੇਰ ਅਸੀਂ ਤੁਹਾਡੀ ਰਿਪੋਰਟ ਲਿਖ ਸਕਦੇ ਹਾਂ ਅਤੇ ਪੂਰਾ ਤੁਸੀਂ ਜੋ ਅੱਖੀਂ ਦੇਖਿਆ ਜਾਂ ਤੁਹਾਡਾ ਫੋਨ ਫੋਨ ਫਿਰ ਅਸੀਂ ਵੇਖਾਂਗੇ ਉਹ ਨੰਬਰ ਦੇਖਾਂਗੇ ਟ੍ਰੇਸ ਕਰਾਂਗੇ ਅਤੇ ਫੇਰ ਹੀ ਤੁਹਾਡੀ ਕੰਪਲੇਂਟ ਲਿਖੀ ਜਾਊਗੀ ਜੀ ਇੱਕ ਵਾਰੀ ਤੁਸੀਂ ਹੁਣ ਕੋਈ ਫੋਨ ਨਾ ਚੱਕਿਆ ਜੇ ਕੋਈ ਰਿਪਲਾਈ ਨਾ ਕਰਿਆ ਜੇ ਅਤੇ ਤੁਸੀਂ ਸਾਡੇ ਕੋਲ ਆ ਕੇ ਥਾਣੇ ਕੋਲ ਵਿੱਚ ਆ ਕੇ ਨਾ ਰਿਪੋਰਟ ਲਿਖਵਾਓ ਠੀਕ ਹੈ ਜੀ ਓਕੇ